ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਭਾਸ਼ਾ ਹੈ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਦੀ ਚੜ੍ਹੀ ਹੋਈ ਹੈ ਅਸੀਂ ਜਨਮ ਤੋਂ ਹੀ ਪੰਜਾਬੀ ਭਾਸ਼ਾ ਸਿੱਖ ਜਾਂਦੇ ਹਾਂ ਬੋਲਣ ਲੱਗ ਜਾਂਦੇ ਹਾਂ ਬਾਕੀ ਪੰਜਾਬੀ ਭਾਸ਼ਾ 'ਚ ਜੋ ਲਿਖਿਆ ਮਿਲਦਾ ਹੈ ਜੋ ਲਿਟਰੇਚਰ ਬਣਿਆ ਹੈ ਬਾਕੀ ਵਿਆਹਾਂ ਸਾਹਾਂ ਦੇ ਵਿੱਚ ਜੋ ਪੰਜਾਬੀ ਭਾਸ਼ਾ ਕਰਕੇ ਅਸੀਂ ਇੱਕ ਦੂਜੇ ਨੂੰ ਸਲਾਉਨੇ ਹਾਂ ਸੁਣਦੇ ਹਾਂ ਬੋਲਦੇ ਹਾਂ ਭੰਗੜੇ ਪੈਂਦੇ ਨੇ ਗੀਤ ਗਾਉਂਦੇ ਨੇ ਪੰਜਾਬੀ ਭਾਸ਼ਾ ਹੀ ਵਧੀਆ ਲੱਗਦੀ ਹੈ ਹੋਰ ਭਾਸ਼ਾ ਕੋਈ ਮਾੜੀ ਨਹੀਂ ਕਹਿ ਸਕਦੇ ਭਾਸ਼ਾ ਸਾਰੀਆ ਹੀ ਵਧੀਆ ਨੇ ਪਰ ਸਾਨੂੰ ਆਪ ਇਹ ਪੰਜਾਬੀ ਭਾਸ਼ਾ ਹੀ ਖਿੱਚ ਦਾ ਕੇਂਦਰ ਹੈ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਵਧੀਆ ਗਾਇਕ ਲਿਟਰੇਚਰ ਫਿਲਮਾਂ ਵੀ ਆ ਰਹੀਆਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਗ੍ਰੰਥ ਸਾਹਿਬ ਵੀ ਲਿਖੇ ਹੋਏ ਨੇ ਹੋਰ ਕੋਈ ਲਿਟਰੇਚਰ ਲਿਖੇ ਹੋਏ ਨੇ ਪੰਜਾਬੀ ਭਾਸ਼ਾ ਦੇ ਵਿੱਚ ਜਦੋਂ ਵੀ ਕੋਈ ਪੰਜਾਬੀ ਸਾਨੂੰ ਮਿਲਦਾ ਹੈ ਬਾਹਰ ਅੰਦਰ ਜਾਈਏ ਤਾਂ ਪੰਜਾਬੀ ਭਾਸ਼ਾ ਓਈਂ ਪ੍ਰਸੰਨ ਹੋ ਜਾਂਦੀ ਹੈ ਪੰਜਾਬੀ ਭਾਸ਼ਾ ਜਿਹਨੂੰ ਅਸੀਂ ਪੰਜਾਬ ਬੋਲਦੇ ਹੈ ਪੰਜਾਬੀ ਤਾਂ ਦੂਜੇ ਦੇਸ਼ ਵਿੱਚ ਵੀ ਪੰਜਾਬੀ ਬੋਲਦੇ ਬੋਲਦੇ ਸੁਣ ਕੇ ਭੱਜ ਕੇ ਮਿਲਦੇ ਨੇ ਵੀ ਪੰਜਾਬ ਦਾ ਬੰਦਾ ਆਇਆ ਹੈ ਇਹ ਪੰਜਾਬੀ ਭਾਸ਼ਾ ਦੀ ਕੁਰਬਾਨੀ ਹੈ ਪੰਜਾਬੀ ਭਾਸ਼ਾ ਦੀ ਸਾਰੀ ਦੇਣ ਹੈ ਸੋ ਸਾਨੂੰ ਪੰਜਾਬੀ ਭਾਸ਼ਾ ਇੰਨੀ ਵਧੀਆ ਲੱਗਦੀ ਹੈ ਜਿਵੇਂ ਅਸੀਂ ਕੋਈ ਆਪਦੀ ਘਰੇ ਬਣਾਈ ਚੀਜ਼ ਖਾ ਲਈ ਕੋਈ ਹੋਰ ਕਰ ਲਈ ਪੰਜਾਬੀ ਭਾਸ਼ਾ ਕਰਕੇ ਹੀ ਅਸੀਂ ਇੱਕ ਦੂਜੇ ਦੇ ਨੇੜੇ ਹੁੰਦੇ ਹਾਂ ਪੰਜਾਬੀ ਭਾਸ਼ਾ ਇਹ ਹੈ ਜਿਹਦੇ ਕਰਕੇ ਅਸੀਂ ਸਾਨੂੰ ਆਪਣੇ ਆਪ ਆਪ ਦੇ ਵਿੱਚ ਮਾਣ ਪ੍ਰਾਪਤ ਹੁੰਦਾ ਹੈ ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਭਾਸ਼ਾ ਹੈ ਦੂਜੀਆਂ ਭਾਸ਼ਾ ਜਿਵੇਂ ਤਮਿਲਨਾਡੂ ਹਰਿਆਣਵੀ ਰਾਜਸਥਾਨੀ ਬੰਗਾਲੀ ਇਹ ਭਾਸ਼ਾ ਸਾਰੀਆਂ ਵਧੀਆ ਨੇ ਪਰ ਸਾਨੂੰ ਤਾਂ ਪੰਜਾਬ ਦੇ ਹੋਣ ਕਰਕੇ ਇਸ 'ਤੇ ਮਾਣ ਹੈ ਬਹੁਤ ਵਧੀਆ ਭਾਸ਼ਾ ਹੈ